ਸਾਡੇ ਧਾਰਮਿਕ ਤਿਉਹਾਰਾਂ ਨਾਲ ਸਬੰਧਿਤ ਖਾਣ ਪੀਣ ਦੀਆਂ ਚੀਜ਼ਾਂ ਵੱਖ ਵੱਖ ਹਨ ਆਮ ਤੌਰ 'ਤੇ ਹਰ ਰੋਜ਼ ਦੀ ਜ਼ਿੰਦਗੀ ਵਿੱਚ ਅਸੀਂ ਘਰਾਂ ਵਿੱਚ ਅਤੇ ਗੁਰਦੁਆਰਿਆਂ ਵਿੱਚ ਸਾਦਾ ਖਾਣਾ ਹੀ ਖਾਂਦੇ ਹਾਂ ਜਿਵੇਂ ਰੋਟੀ ਦਾਲ ਚਾਵਲ ਸਬਜ਼ੀਆਂ ਅਲੱਗ ਤਰ੍ਹਾਂ ਤਰ੍ਹਾਂ ਦੀਆਂ ਬਦਲ ਬਦਲ ਕੇ ਮਿੱਠੇ ਵਿੱਚ ਕੜਾਹ ਬਣਾ ਲੈਂਦੇ ਹਾਂ ਜਾਂ ਖੀਰ ਪਰ ਧਾਰਮਿਕ ਤਿਉਹਾਰਾਂ ਵਿੱਚ ਜਿਵੇਂ ਗੁਰੂ ਸਾਹਿਬਾਨਾਂ ਅਤੇ ਪ੍ਰਕਾਸ਼ ਗੁਰਪੁਰਬ ਜੋਤੀ ਜੋਤ ਦਿਵਸ ਫਤਿਹ ਦਿਵਸ ਗੁਰਗੱਦੀ ਦਿਵਸ ਇਹਨਾਂ ਦਿਨਾਂ ਵਿੱਚ ਖਾਸ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ ਜਿਵੇਂ ਜਲੇਬੀਆਂ ਪਕੌੜੇ ਸਾਰੇ ਫਲ ਕੱਟ ਕੇ ਇਕੱਠਾ ਕਰਕੇ ਫਰੂਟ ਚਾਟ ਅੱਜ ਕੱਲ੍ਹ ਤਾਂ ਕੇਕ ਪੇਸਟਰੀਆਂ ਵੀ ਵਰਤਣ ਲੱਗ ਪਏ ਹਨ ਪੀਜ਼ਾ ਬਰਗਰ ਨੂਡਲ ਚਾਪ ਦਾ ਵੀ ਲੰਗਰ ਲਗਾਉਣ ਲੱਗ ਪਏ ਹਨ ਡੋਸਾ ਇਡਲੀ ਸਾਂਬਰ ਬੜਾ ਪਾਓ ਭਾਜੀ ਵੀ ਲੰਗਰ ਵਿੱਚ ਸ਼ਾਮਿਲ ਹੋ ਗਏ ਹਨ ਟਿੱਕੀ ਵੀ ਜੂਸ ਵੀ ਬਦਾਮਾਂ ਵਾਲਾ ਦੁੱਧ ਵੀ ਜਿਵੇਂ ਸ਼ਹੀਦੀ ਦਿਨਾਂ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਵਿੱਚ ਠੰਡੇ ਮਿੱਠੇ ਜਲ ਅਤੇ ਦੁੱਧ ਅਤੇ ਸ਼ਰਦਈ ਦਾ ਲੰਗਰ ਵੀ ਲਗਾਇਆ ਜਾਂਦਾ ਹੈ ਧਾਰਮਿਕ ਤਿਉਹਾਰਾਂ ਵਿੱਚ ਦਿਵਾਲੀ ਵਿਸਾਖੀ ਦੁਸਹਿਰਾ ਵੀ ਸ਼ਾਮਿਲ ਹੈ ਉਦੋਂ ਵੀ ਜਿਵੇਂ ਹੋਲੀ ਵਿੱਚ ਭੰਗ ਦੇ ਪਕੌੜੇ ਖਾਸ ਕਰਕੇ ਬਣਾਏ ਜਾਂਦੇ ਹਨ ਭੰਗ ਵੀ ਬਹੁਤ ਲੋਕ ਪੀਂਦੇ ਹਨ ਦੁਸਹਿਰੇ ਨੂੰ ਗੰਨੇ ਸਭ ਲੋਕ ਖਰੀਦ ਦੇ ਹਨ ਚੂਪਦੇ ਹਨ ਜਲੇਬੀਆਂ ਵੀ ਖਾਂਦੇ ਹਨ ਸਭ ਲੋਕ ਵਿਸਾਖੀ ਨੂੰ ਵੀ ਜਲੇਬੀਆਂ ਖਰੀਦਦੇ ਹਨ ਅਤੇ ਇੱਕ ਦੂਜੇ ਨੂੰ ਵੰਡਦੇ ਅਤੇ ਖਾਂਦੇ ਹਨ ਬਦਾਮਾਂ ਵਾਲਾ ਕਾੜ ਕੇ ਅਤੇ ਕੇਸਰ ਪਾ ਕੇ ਦੁੱਧ ਵਰਤਾਇਆ ਜਾਂਦਾ ਹੈ ਸਭ ਨੂੰ ਦਿਵਾਲੀ ਦੇ ਤਾਂ ਕਿਆ ਕਹਿਣੇ ਕੋਈ ਘਰ ਐਸਾ ਨਹੀਂ ਹੁੰਦਾ ਜਿਸ ਘਰ ਵਿੱਚ ਮਿਠਾਈ ਨਾ ਆਵੇ ਬਹੁਤ ਤਰ੍ਹਾਂ ਦੀਆਂ ਮਿਠਾਈਆਂ ਪਿੰਨੀਆਂ ਪਤੀਸੇ ਕਾਜੂ ਕਤਲੀ ਮਿਲਕ ਕੇਕ ਆਦਿ ਦੇ ਡੱਬੇ ਇੱਕ ਦੂਜੇ ਨੂੰ ਉਪਹਾਰ ਦੇ ਵਿੱਚ ਦਿੱਤੇ ਜਾਂਦੇ ਹਨ ਲੋਕ ਆਪਣੇ ਵਰਕਰਾਂ ਨੂੰ ਦਿਵਾਲੀ ਵਿੱਚ ਮਿਠਾਈਆਂ ਦੇ ਡੱਬੇ ਅਤੇ ਕੋਈ ਨਾ ਕੋਈ ਗਿਫਟ ਵੀ ਦਿੰਦੇ ਹਨ